ਨਹੀਂ ਸਾਨੂੰ ਇਸ ਦੇ ਵਿੱਚ ਨਹੀਂ ਲੱਗਦਾ ਕਿ ਗ੍ਰਹਿਆਂ 'ਤੇ ਕਿਸੇ ਹੋਰ ਗ੍ਰਹਿ 'ਤੇ ਜੀਵਨ ਹੈ ਕਿਉਂਕਿ ਅਗਰ ਕੋਈ ਵੀ ਕਿਸੇ ਹੋਰ ਗ੍ਰਹਿ 'ਤੇ ਜਾ ਰਿਹਾ ਤਾਂ ਉੱਥੋਂ ਕੋਈ ਵੀ ਇਹੋ ਜਿਹਾ ਦਿਲ ਦਿਲਚਪ ਦਿਲਚਸਪ ਜਾਂ ਉੱਥੋਂ ਦੇ ਕੋਈ ਵੀ ਇਹੋ ਜਿਹੇ ਸਾਨੂੰ ਕਾਰਨ ਨਹੀਂ ਮਿਲੇ ਕਿ ਉੱਥੇ ਜੀਵਨ ਦੀ ਉਤਪਤੀ ਹੋ ਸਕੇ ਜਾਂ ਉੱਥੇ ਆਦਮੀ ਦਾ ਰਹਿਣਾ ਸੰਭਵ ਹੋ ਸਕੇ ਇਸ ਲਈ ਮੈਂ ਨਹੀਂ ਮੰਨਦਾ ਕਿ ਕਿਸੇ ਹੋਰ ਗ੍ਰਹਿ 'ਤੇ ਜੀਵਨ ਹੈ ਧੰਨਵਾਦ